ਮੈਂ ਕਦੇ ਵੀ ਫੋਟੋਗ੍ਰਾਫੀ ਨੂੰ ਐਜ਼ ਏ ਪੇਸ਼ੇ ਵਜੋਂ ਨਹੀਂ ਸ ਸੋਚਿਆ ਪਰ ਮੈਨੂੰ ਫੋਟੋਗ੍ਰਾਫੀ ਦਾ ਬਹੁਤ ਸ਼ੌਕ ਹੈ ਅੱਜ ਕੱਲ੍ਹ ਜਿਹੜੀ ਵਿਆਹ ਦੀ ਫੋਟੋਗ੍ਰਾਫੀ ਕੀਤੀ ਜਾਂਦੀ ਹੈ ਉਹ ਡਿਜ਼ੀਟਲ ਹੈ ਬਹੁਤ ਵਧੀਆ ਟਰਾਂਸਪੇਰੈਂਟ ਆ ਉਹਦੇ 'ਤੇ ਪਾਣੀ ਗਿਰੇ ਕੁਛ ਵੀ ਹੋਵੇ ਉਹ ਫੋਟੋਆਂ ਖਰਾਬ ਨਹੀਂ ਹੁੰਦੀਆਂ ਪੈਨ ਡਰਾਈਵ ਵਗੈਰਾ 'ਚ ਪੈ ਜਾਂਦੀਆਂ ਨੇ ਕਿਸੇ ਵੀ ਤੁਸੀਂ ਉਸ 'ਤੇ ਖੜ੍ਹਕੇ ਲੈਪਟੋਪ 'ਤੇ ਐਲ ਈ ਡੀ 'ਤੇ ਕਿਤੇ ਵੀ ਬਹਿ ਕੇ ਦੇਖ ਸਕਦੇ ਹੋ ਪੁਰਾਣੇ ਟਾਈਮ ਦੇ ਵਿੱਚ ਇਹ ਹੁੰਦਾ ਸੀ ਕਿ ਫੋਟੋਗ੍ਰਾਫੀ ਇੰਨੀ ਵਧੀਆ ਨਹੀਂ ਸੀ ਹੁੰਦੀ ਅਤੇ ਉਹ ਐਲਬਮਾਂ ਛੇਤੀ ਖਰਾਬ ਵੀ ਹੋ ਜਾਂਦੀਆਂ ਸੀ ਬਟ ਹੁਣ ਅੱਜ ਕੱਲ੍ਹ ਦੀ ਡਿਜ਼ੀਟਲ ਫੋਟੋਗ੍ਰਾਫੀ ਬਹੁਤ ਵਧੀਆ ਇਹ ਕਿਤੇ ਵੀ ਤੁਸੀਂ ਫੀਡ ਕਰਕੇ ਰੱਖ ਸਕਦੇ ਹੋ ਇਹਦਾ ਜ਼ਿਆਦਾ ਬੈਨੀਫਿਟ ਹੈ ਅਤੇ ਜਿਹੜੀ ਫੋਟੋਗ੍ਰਾਫੀ ਪੇਸ਼ੇ ਵਜੋਂ ਹੁੰਦੀ ਵਧੀਆ ਜੇ ਕੋਈ ਕਰਦਾ ਤਾਂ ਬਹੁਤ ਇਹਦੇ ਵਿੱਚ ਪੈਸਾ ਬਣਦਾ ਪਰ ਮੈਂ ਕਦੇ ਵੀ ਇਹ ਨਹੀਂ ਸੋਚਿਆ ਕਿ ਮੈਂ ਇਹ ਪੇਸ਼ੇ ਵਜੋਂ ਇਹਨੂੰ ਯੂਜ਼ ਕਰਾਂ ਮੈਨੂੰ ਇਹ ਗੱਲ ਨਹੀਂ ਅੱਛੀ ਲੱਗੀ ਮੈਨੂੰ ਇਹ ਬਿਜਨਸ ਵਧੀਆ ਨਹੀਂ ਲੱਗਦਾ ਨਾ ਹੀ ਮੈਨੂੰ ਇਹਦੇ ਬਾਰੇ ਕੋਈ ਨੌਲੇਜ ਹੈ ਅਤੇ ਨਾ ਹੀ ਮੈਂ ਕਦੇ ਇਹਦੇ ਬਾਰੇ ਸੋਚਿਆ ਜੀ